ਨਮਸਤੇ ਸਰ ਜੀ ਹਾਂਜੀ ਮੈਂ ਰਿਤੂ ਬਾਲਾ ਢੇਸੀਆਂ ਤੋਂ ਹਾਂਜੀ ਇਹ ਪਠਾਨਕੋਟ ਸਾਡੇ ਮਲ ਕਿ ਏਰੀਏ ਵਿੱਚ ਕਿਹੜਾ ਕਿਹੜਾ ਥੀਏਟਰ ਹੈ ਹਾਂ ਸਾਡੇ ਪਠਾਨਕੋਟ ਵਿੱਚ ਥੀਏਟਰ ਬਹੁਤ ਵੱਡਾ ਆ ਅਸੀਂ ਉੱਥੇ ਮਲ ਕਿ ਫਿਲਮ ਦੇਖਣ ਗਏ ਸੀ ਅਤੇ ਉੱਥੇ ਅਸੀਂ ਫੈਮਲੀ ਪੂਰੀ ਗਏ ਸੀ ਫਿਲਮਾਂ ਦੇਖਣ ਅਤੇ ਆਪਣੇ ਹਸਬੈਂਡਾਂ ਨਾਲ ਗਏ ਸੀ ਉੱਥੇ ਜਾ ਕੇ ਅਸੀਂ ਪਤਾ ਕਿਹੜੀ ਕਿਹੜੀ ਫਿਲਮ ਦੇਖੀ ਬੇਟਾ ਫਿਲਮ ਦੇਖੀ ਅਤੇ ਉਹਦੇ ਵਿੱਚ ਮਲ ਕਿ ਜਿਹੜੀ ਉਹਦੀ ਅਸਲੀ ਮਾਂ ਸੀ ਅਨਿਲ ਕਪੂਰ ਦੀ ਅਤੇ ਉਹ ਮਰ ਗਈ ਸੀ ਛੋਟੇ ਹੁੰਦੇ ਹੀ ਅਤੇ ਉਹਦੇ ਵਿੱਚ ਨਾ ਜਿਹੜੀ ਦੂਸਰੀ ਸੀ ਮਾਂ ਜਿਹੜੀ ਆਈ ਸੀ ਤਾਂ ਉਹਨੇ ਉਹਨੂੰ ਅਨਪੜ੍ਹ ਰੱਖਿਆ ਅਤੇ ਉਹਦੇ ਕੋਲੋਂ ਮਲ ਕਿ ਘਰ ਦਾ ਕੰਮ ਖੇਤੀਬਾੜੀ ਦਾ ਕੰਮ ਕਰਵਾਇਆ ਅਤੇ ਉਹਨੂੰ ਆਪਣੇ ਮਲ ਕਿ ਜਾਇਦਾਦ ਤੋਂ ਮਲ ਕਿ ਹੱਕ ਨਹੀਂ ਦਿੱਤਾ ਅਤੇ ਜਿਹੜੀ ਮਾਧੁਰੀ ਦਿਕਸ਼ਿਤ ਜਿਹੜੀ ਆਈ ਸੀ ਅਤੇ ਉਹਨੇ ਮਲ ਕਿ ਆਪਣੇ ਘਰ ਵਾਲੇ ਨੂੰ ਅਨਿਲ ਕਪੂਰ ਨੂੰ ਮਲ ਕਿ ਠੀਕ ਫੈਮਲੀ ਵਿੱਚ ਠੀਕ ਠਾਕ ਬਣਾਇਆ ਅਤੇ ਮਾਂ ਦਾ ਮਲ ਕਿ ਸੱਚਾਈ ਜਿਹੜੀ ਮਾਂ ਦੀ ਹੈ ਉਹ ਸਾਹਮਣੇ ਲਿਆਂਦੀ ਅਤੇ ਜਿਹੜਾ ਉਹਦਾ ਆਪਣਾ ਬੇਟਾ ਸੀ ਮਲ ਕਿ ਉਹ ਮਲ ਕਿ ਚੰਗਾ ਨਹੀਂ ਨਿਕਲਿਆ ਅਤੇ ਅਨਿਲ ਕਪੂਰ ਉਹਦੇ ਮਲ ਕਿ ਬੇਟਾ ਬਣਿਆ ਉਹਨੂੰ ਵੀ ਮਾਂ ਨੇ ਉਹਨੂੰ ਆਪਣਾ ਬੇਟਾ ਸਮਝਿਆ ਐਂਡ 'ਤੇ ਅਤੇ ਹੋਰ ਅਸੀਂ ਦੇਖੀ ਮਲ ਕਿ ਗਦਰ ਫਿਲਮ ਦੇਖੀ ਜਿਹੜੀ ਮਲ ਕਿ ਅਮੀਸ਼ਾ ਪਟੇਲ ਸੀ ਪਾਕਿਸਤਾਨ ਵਿੱਚ ਰਹਿ ਗਈ ਅਤੇ ਉਹ ਸਨੀ ਦਿਓਲ ਨੇ ਉਹਦੇ ਨਾਲ ਵਿਆਹ ਕੀਤਾ ਉਹ ਹਿੰਦੁਸਤਾਨ ਵਿੱਚੋਂ ਮਲ ਕਿ ਉਹਦੇ ਮਾਂ ਪਿਓ ਉਹਨੂੰ ਲੈਣ ਗਏ ਅਤੇ ਉਹ ਨਹੀਂ ਆਈ ਇਹ ਫਿਲਮ ਦੇਖੀ ਗੀ ਗਦਰ ਫਿਲਮ ਸਨੀ ਦਿਓਲ ਦੀ ਔਰ ਫੂਲ ਓਰ ਕਾਂਟੇ ਦੇਖੀ ਅਜੇ ਦੇਵਗਨ ਦੀ ਫਿਲਮ ਜਿਹਦੇ ਵਿੱਚ ਜਿਹੜੀ ਮਲ ਕਿ ਉਹਦਾ ਅਜੈ ਦੇਵਗਨ ਦਾ ਬੇਟਾ ਸੀ ਉਹ ਉਹਦੇ ਮਲ ਕਿ ਅਮਰਿਸ਼ ਪੁਰੀ ਨੇ ਉਹਨੂੰ ਕਿਡਨੇਟ ਕਰਕੇ ਅਤੇ ਉਹਦਾ ਮਲ ਕਿ ਕੀਤਾ ਉਹਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਥੱਲੇ ਅਤੇ ਉਹਦੇ ਬੇਟੇ ਦਾ ਅਤੇ ਉਹਦਾ ਮਲ ਕਿ ਝਗੜਾ ਚੱਲਿਆ ਰਿਹਾ ਅਤੇ ਇੱਕ ਹੋਰ ਇਹ ਫਿਲਮ ਦੇਖੀ ਅਜੈ ਦੇਵਗਨ ਦੀ ਫੂਲ ਔਰ ਕਾਂਟੇ ਅਤੇ ਇਹ ਫਿਲਮਾਂ ਦੇਖੀਆਂ ਥੀਏਟਰ ਵਿੱਚ ਅਤੇ ਸਾਨੂੰ ਠੀਕ ਲੱਗੀਆਂ ਬੜੀਆਂ ਪਸੰਦ ਆਈਆਂ ਹਾਂਜੀ ਠੀਕ ਹੈ ਸਰ ਜੀ